ਮੇਰੀ ਮਨਪਸੰਦ ਖੇਡ ਕ੍ਰਿਕਟ ਹੈ ਮੈਨੂੰ ਯਾਦ ਹੈ ਕਿ ਮੈਂ ਜਦੋਂ ਕ੍ਰਿਕਟ ਖੇਡਦਾ ਹੁੰਦਾ ਸੀਗਾ ਤਾਂ ਅਸੀਂ ਇਕੱਠੇ ਦਸ ਗਿਆਰਾਂ ਦੋਸਤ ਇਕੱਠੇ ਹੋਣਾ ਸਾਡੇ ਲਈ ਇੱਕ ਅਨੋਖਾ ਅਨੁਭਵ ਹੁੰਦਾ ਸੀਗਾ ਕਿ ਅਸੀਂ ਇੱਕ ਦੂਜੇ ਨੂੰ ਘਰੋਂ ਲੈਣ ਜਾਂਦੇ ਹੁੰਦੇ ਸੀਗੇ ਉਸ ਸਮੇਂ ਸਾਡੇ ਕੋਲ ਫੋਨ ਨਹੀਂ ਹੁੰਦੇ ਸੀਗੇ ਅਸੀਂ ਜਦੋਂ ਘਰੋਂ ਲੈਣ ਜਾਣਾ ਤਾਂ ਸਾਨੂੰ ਇਹ ਯਾਦ ਆ ਕਿ ਕਈਆਂ ਦੇ ਘਰਾਂ ਦੇ ਮੰਮੀ ਜਿਨ੍ਹਾਂ ਦੇ ਨਾਲ ਸਾਡੇ ਦੋਸਤ ਹੁੰਦੇ ਸੀਗੇ ਉਹਨਾਂ ਦੇ ਮੰਮੀ ਡੈਡੀ ਸਾਨੂੰ ਗਾਲਾਂ ਤੱਕ ਦਿੰਦੇ ਹੁੰਦੇ ਸੀਗੇ ਕਿ ਸਾਡੇ ਨਿਆਣਿਆਂ ਨੂੰ ਤੁਸੀਂ ਵਿਗਾੜ ਰਹੇ ਆ ਅਸੀਂ ਇਹ ਨਹੀਂ ਚਾਹੁੰਦੇ ਹੁੰਦੇ ਸੀਗੇ ਕਿ ਉਹ ਵਿਗੜਨ ਅਸੀਂ ਤਾਂ ਇੱਕ ਤੰਦਰੁਸਤ ਰਹਿਣ ਲਈ ਇਹ ਖੇਡ ਦਾ ਨਿਯਮ ਬਣਾਇਆ ਹੋਇਆ ਸੀਗਾ ਕਿ ਅਸੀਂ ਖੇਡੀਏ ਇਸ ਲਈ ਅਸੀਂ ਉਹਨਾਂ ਨੂੰ ਇੱਕ ਚੰਗੇ ਦੋਸਤ ਮੰਨਦੇ ਸੀਗੇ ਅਤੇ ਮੇਰੇ ਲਈ ਇੱਕ ਯਾਦ ਆ ਕਿ ਜਦੋਂ ਉਹਨਾਂ ਦੇ ਮੰਮੀ ਡੈਡੀ ਸਾਨੂੰ ਨ ਗਾਲਾਂ ਕੱਢਦੇ ਹੁੰਦੇ ਕਿ ਸਾਨੂੰ ਰੋਕਦੇ ਹੁੰਦੇ ਸੀਗੇ ਕਿ ਤੁਸੀਂ ਖੇਡਾਂ ਨਾ ਖੇਡੋ